ਪੰਜਾਬ ਵਿੱਚ ਕਾਰੋਬਾਰਾਂ ਦੇ ਸੰਚਾਲਨ ਨੂੰ ਨਿਯੁਕਤ ਕਰਨ ਵਾਲੇ ਕਈ ਮ ਮੁੱਖ ਵਿ ਵਪਾਰਕ ਕਾਨੂੰਨ ਅਤੇ ਨਿਯਮ ਹਨ ਜੋ ਕਾਰੋਬਾਰ ਨੂੰ ਸੁਰੱਖਿਅਤ ਅਤੇ ਕਾਨੂੰਨ ਤੌਰ 'ਤੇ ਸੁ ਸੁਚੱਜਾ ਬਣਾਉਂਦੇ ਹਨ ਇਹਨਾਂ ਵਿੱਚ ਕੁਝ ਪ੍ਰਮੁੱਖ ਕਾ ਕਾਨੂੰਨ ਹੇਠਾਂ ਦਿੱਤੇ ਗਏ ਹਨ ਕੰਪਨੀ ਕਾਨੂੰਨ ਇਹ ਕਾਨੂੰਨ ਕੰਪਨੀਆਂ ਨੂੰ ਕੀ ਕਾਇਮ ਕਰਨ ਉਹਨਾਂ ਦੇ ਰਜਿਸਟਰੇਸ਼ਨ ਪ੍ਰਬੰਧ ਅਤੇ ਕਾਰੋਬਾਰ ਦੇ ਸੰਚਾਲਨ ਲਈ ਮੂਲ ਨਿਯਮਾਂ ਨੂੰ ਨਿਰਧਾਰਿਤ ਕਰਦਾ ਕਰਦਾ ਹੈ ਇਸ ਨੂੰ ਕੰਪਨੀ ਐਕਟ ਦੋ ਹਜ਼ਾਰ ਤੇਰਾਂ ਦੇ ਤਹਿਤ ਲਾਗੂ ਕੀਤਾ ਜਾਂਦਾ ਹੈ ਜੋ ਕੰਪਨੀਆਂ ਦੀ ਪੇਸ਼ ਪੇਸ਼ਾਵਰ ਅਤੇ ਆਰਥਿਕਤਾ ਨੂੰ ਵਿ ਵਿਦਿਆ ਵਿਦਿਕ ਤੌਰ 'ਤੇ ਨਿਯੁਕਤ ਕਰਦੇ ਹਨ ਇੱਕ ਇਨਕਮ ਟੈਕਸ ਐਕਟ ਇਹ ਕਾਨੂੰਨ ਕਾਰੋਬਾਰ ਕਾਰੋਬਾਰਾਂ ਅਤੇ ਵਿਅਕਤੀਆਂ ਨੂੰ ਹੁਣ ਹੋਣ ਵਾਲੀ ਆਮਦਨੀ 'ਤੇ ਟੈਕਸ ਲਗਾਉਂਦਾ ਹੈ ਪੰਜਾਬ ਵਿੱਚ ਇਸ ਕਾਨੂੰਨ ਦੇ ਤਹਿਤ ਸਥਾਨਕ ਰਾਜ ਅਤੇ ਕੇਂਦਰ ਸਰਕਾਰ ਵੱਲੋਂ ਟੈਕਸ ਦੀ ਰਿਆ ਰਿਵਾਈਡ ਰਿਵਾਇਤੀ ਅਤੇ ਆਧੁਨਿਕ ਨੀ ਨੀਤੀਆਂ ਨੂੰ ਲੈ ਲਾਗੂ ਕੀਤਾ ਜਾਂਦਾ ਹੈ ਇਹ ਕਾਨੂੰਨ ਕਾਰੋਬਾਰ ਅਤੇ ਦੁਕਾਨਾਂ ਦੇ ਘਰੇਲੂ ਸ ਸਥਾਨਾਂ ਅਤੇ ਮਿਆਰੀ ਸਮੇਤ ਸਥਾਪਤ ਕਰਦਾ ਹੈ ਇਹ ਇਹ ਮੂਹੀ